ਹਾਂਜੀ ਅਸੀਂ ਧਾਰਮਿਕ ਮੌਕਿਆਂ ਲਈ ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦੇ ਹਨ ਕਿਉਂਕਿ ਇਹ ਕੰਮ ਕਰਕੇ ਸਾਨੂੰ ਦਿਲ 'ਚ ਸਾਡੇ ਦਿਲ 'ਚ ਸਕੂਨ ਮਿਲਦਾ ਹੈ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਸਾਨੂੰ ਇੰਝ ਲੱਗਦਾ ਹੈ ਕਿ ਅਸੀਂ ਰੱਬ ਨੂੰ ਸੱਚੀ ਪ੍ਰਾਪਤ ਕਰ ਲਿਆ ਹੈ ਇਹਦੇ ਵਿੱਚ ਜਿਹੜੇ ਖੁਸ਼ੀ ਹੁੰਦੀ ਹੈ ਉਹ ਜ਼ਾਹਿਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਡੇ ਧਰਮ ਵਿੱਚ ਬਹੁਤ ਸਾਰੇ ਦੇਵੀ ਦੇਵਤਾ ਹੈ ਜਿਹਨਾਂ ਦੇ ਵੱਖਰੇ ਵੱਖਰੇ ਰੂਪ ਹਨ ਜਿਹਨਾਂ ਨੂੰ ਜਿਹਨਾਂ ਨੂੰ ਜਿਹਨਾਂ ਰੂਪਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਦਰਸਾਉਣਾ ਹੁੰਦਾ ਹੈ ਇਸ ਕਰਕੇ ਦੇਵਤਿਆਂ ਦੀ ਮੂਰਤੀਆਂ ਬਣਾਉਣਾ ਇੱਕ ਕਲਾ ਹੈ ਜੋ ਕਿ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਹੁੰਦੀ ਹੈ ਸਾਰੇ ਆਪਣੇ ਰੂਸੀ ਰੁਚੀ ਅਨੁਸਾਰ ਵੱਖ ਵੱਖ ਚੀਜ਼ਾਂ ਕਰਦੇ ਹਾਂ ਜਿੱਦਾਂ ਕਿ ਮੈਨੂੰ ਆਪਣੀ ਰੁਚੀ ਦੇ ਹੀ ਅਨੁਸਾਰ ਦੇਵਤਿਆਂ ਦੀਆਂ ਮੂਰਤੀਆਂ ਬਣਾਉਣਾ ਚੰਗੀਆਂ ਲੱਗਦੀਆਂ ਹੈ ਮੈਂ ਅੱਜ ਤੱਕ ਬਹੁਤ ਸਾਰੇ ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ ਹਨ